ਵੈਸੇ ਤਾਂ ਆਪਾਂ ਗੱਲ ਕੀਤੀ ਜਾਵੇ ਮੈਨੂੰ ਬਹੁਤ ਹੀ ਜ਼ਿਆਦਾ ਚੀਜ਼ਾਂ ਦੇਣੀਆਂ ਗਰਾਂਟਿਡ ਕਾਰਡ ਜਾਂ ਮੂਰਤੀ ਜਾਂ ਪੱਤਰ ਦੇਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਆਪਣਾ ਦੋਸਤ ਆਪਣੇ ਦੋਸਤ ਨੂੰ ਕਈ ਵਾਰ ਪੱਤਰ ਵੀ ਲਿਖਦਾ ਹਾਂ ਜਿਸ ਪੱਤਰ ਦੇ ਵਿੱਚ ਮੈਂ ਆਪਣੀ ਫੀਲਿੰਗ ਜਾਹਿਰ ਕਰਦਾ ਹਾਂ ਜਿਵੇਂ ਕਿ ਅਗਰ ਮੇਰੇ ਤੋਂ ਕੋਈ ਗੱਲ ਉਹਨੂੰ ਫੇਸ ਟੂ ਫੇਸ ਨਹੀਂ ਕਹੀ ਜਾਂਦੀ ਸਾਹਮਣੇ ਸਾਹਮਣੇ ਨਹੀਂ ਕਹੀ ਜਾਂਦੀ ਉਸ ਨੂੰ ਮੈਂ ਪੱਤਰ ਦੇ ਵਿੱਚ ਲਿਖ ਕੇ ਜਾਹਰ ਕਰਦਾ ਹਾਂ ਜਹਿਰ ਕਰਦਾ ਹਾਂ ਅਤੇ ਗਰੇਂਟਡ ਕਾਰਡ ਵੀ ਮੈਨੂੰ ਬਹੁਤ ਦੇਣਾ ਪਸੰਦ ਹੈ ਮੂਰਤੀ ਮੈਨੂੰ ਗਿਫਟ ਦੇ ਤੌਰ 'ਤੇ ਬਹੁਤ ਹੀ ਦੇਣਾ ਪਸੰਦ ਹੈ ਅੱਜ ਤੱਕ ਮੈਂ ਆਪਣੀ ਲਾਈਫ ਦੇ ਵਿੱਚ ਹੱਥ ਦੇ ਨਾਲ਼ ਮੈਨੂੰ ਪੇਂਟਿੰਗ ਬਹੁਤ ਕਰਨੀ ਪਸੰਦ ਹੁੰਦੀ ਹੈ ਜਿਵੇਂ ਆਪਣਾ ਦੇਸ਼ ਦਾ ਤਿਰੰਗਾ ਬਣਾਉਣਾ ਤਿਰੰਗੇ ਦੇ ਵਿੱਚ ਆਪਾਂ ਰ ਕਲਰ ਭਰਨਾ ਕੋਈ ਆਪਣਾ ਤਰੰਗੇ ਨੂੰ ਵਧੀਆ ਸ਼ੇਪ ਦੇਣੀ ਐਨ ਬਹੁਤ ਵਧੀਆ ਤਿਰੰਗਾ ਬਣਾਉਂਦਾ ਹਾਂ ਮੈਂ ਪੇਂਟ ਕਰਦਾ ਹਾਂ ਆਪਣੇ ਹੱਥੀਂ ਅਤੇ ਆਪਾਂ ਦੂਜੀ ਗੱਲ ਕੀਤੀ ਜਾਵੇ ਤਾਂ ਮੈਨੂੰ ਇੱਕ ਤਲਾਅ ਦੇ ਨੇ ਨੇੜੇ ਬ ਬੰਦਾ ਖੜ੍ਹਾ ਮਛਲੀ ਫੜ ਰਿਹਾ ਉਹਦੇ ਨਾਲ਼ ਦੀ ਪੇਂਟਿੰਗ ਆਲ਼ੇ ਦੁਆਲ਼ੇ ਆਵਾਜਾਈ ਚੱਲ ਰਹੀ ਹੈ ਪੇੜ ਪੌਦੇ ਆਪਣੇ ਹਿਲ ਰਹੇ ਹਨ ਬੜੀਆ ਤਰੀਕੇ ਦੇ ਨਾਲ਼ ਉਹ ਮੈਨੂੰ ਕਰਨਾ ਬਹੁਤ ਜ਼ਿਆਦਾ ਹੀ ਪਸੰਦ ਹੈ